ਹਾਂਜੀ ਮੈਂ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਅਤੇ ਨੁਕਤੇ ਸਿੱਖੇ ਹਨ ਜਿਨ੍ਹਾਂ ਨਾਲ ਕੀ ਹੈ ਮੇਰੀ ਚਿੱਤਰਕਾਰੀ ਹੋਰ ਬਿਹਤਰ ਬਣੀ ਹੈ ਜਿਵੇਂ ਕਿ ਰੇਤ ਯਾ ਫਿਰ ਧਾਗੇ ਤੋਂ ਡਰਾਇੰਗ ਬਣਾਉਣਾ ਰੇਤ ਯਾ ਧਾਗੇ ਤੋਂ ਬਣਾਈ ਗਈ ਡਰਾਇੰਗ ਬਹੁਤ ਹੀ ਸੋਹਣੀ ਦਿਖਦੀ ਹੈ ਅਤੇ ਲੋਕ ਇਸ ਨਵੇਂ ਤਰੀਕੇ ਨੂੰ ਵੀ ਬਹੁਤ ਮਸ ਪਸੰਦ ਕਰਦੇ ਹਨ ਜਿਵੇਂ ਕਿ ਮੈਂ ਰੇਤ 'ਤੇ ਡਰਾਇੰਗ ਤੋਂ ਬਹੁਤ ਸਾਰੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਡਰਾਇੰਗਾਂ ਬਣਾਈਆਂ ਹਨ ਇਹ ਇੰਨਾ ਦਿਲਚਪਫ ਦਿਲਚਸਪ ਹੈ ਕਿ ਮੈਂ ਇਸ ਵੱਲ ਬਹੁਤ ਜ਼ਿਆਦਾ ਹੀ ਆਕਰਸ਼ਿਤ ਹੋ ਗਈ ਹਾਂ ਮੈਂ ਬਹੁਤ ਮੋਸਟਲੀ ਆਪਣੇ ਡਰਾਇੰਗ ਰੇਤ ਜਾਂ ਧਾਗੇ ਤੋਂ ਬਣਾਉਣੀਆਂ ਸਟਾਟ ਕੀਤੀਆਂ ਹੋਈਆਂ ਹਨ ਅਤੇ ਇਹ ਸਾਰਾ ਕੁਝ ਮੈਂ ਯੂਟਿਊਬ ਤੋਂ ਹੀ ਸਿੱਖਿਆ ਹੈ ਯੂਟਿਊਬ ਹੀ ਮੇਰਾ ਔਨਲਾਈਨ ਸਰੋਤ ਹੈ ਜੋ ਕਿ ਮੈਨੂੰ ਨਵੀਆਂ ਤਕਨੀਕਾਂ ਸਿਖਣਾ ਸਿਖਾਲਉਂਦਾ ਹੈ ਅਤੇ ਯੂਟਿਊਬ ਤੋਂ ਹੀ ਮੈਂ ਰੋਜ਼ ਨਾ ਰੋਜ਼ ਕੁਝ ਨਾ ਕੁਝ ਸਿੱਖਦੀ ਰਹਿੰਦੀ ਹਾਂ ਜਿਸ ਨਾਲ ਕਿ ਮੈਨੂੰ ਨਵੇਂ ਤਰੀਕਿਆਂ ਬਾਰੇ ਪਤਾ ਲੱਗਦਾ ਹੈ ਅਤੇ ਨਵੇਂ ਤਰੀਕੇ ਦੀ ਡਰਾਇੰਗ ਫੋਲੋ ਕਰਨ ਦਾ ਵੀ ਮਜ਼ਾ ਆਉਂਦਾ ਹੈ ਅਤੇ ਹਰ ਕੋਈ ਮੇਰੀ ਇਸ ਡਰਾਇੰਗ ਦੀ ਤਾਰੀਫ ਕਰਦਾ ਹੈ ਅਤੇ ਕੋ ਹਰ ਕੋਈ ਪੁੱਛਦਾ ਹੈ ਕਿ ਇਹ ਡਰਾਇੰਗ ਕਿੱਦਾਂ ਅਤੇ ਕਿਸ ਤਰ੍ਹਾਂ ਬਣੀ ਹੈ ਜਿਸ ਨਾਲ ਕਿ ਮੈਨੂੰ ਬਹੁਤ ਸਾਰੀ ਖੁਸ਼ੀ ਮਿਲਦੀ ਹੈ ਅਤੇ ਮੈਂ ਇਸ ਤਰੀਕੇ ਨੂੰ ਆਪਣੇ ਵਧੀਆ ਹੋਰ ਵਧੀਆ ਬਣਾਉਣ ਲਈ ਔਨਲਾਇਨ ਦੇਖਦੀ ਰਹਿੰਦੀ ਹਾਂ ਕਿ ਮੈਂ ਇਸ ਵਿੱਚ ਕੀ ਕੁਝ ਐਡ ਕਰ ਸਕਦੀ ਐ ਜਾਂ ਕਿਸ ਤਰ੍ਹਾਂ ਇਸ ਨੂੰ ਹੋਰ ਤੋਂ ਵਧੀਆ ਬਣਾ ਸਕਦੀ ਹਾਂ